ਵਾਲਾਂ ਅਤੇ ਚਮੜੀ ਦੀ ਦੇਖਭਾਲ ਕਰਨ ਲਈ ਸਾਡੇ ਪਿੰਡ ਵਿੱਚ ਬਹੁਤ ਘਰੇਲੂ ਨੁਸਖੇ ਕਰਵਾਏ ਜਾਂਦੇ ਹਨ ਅਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਵਾਲਾਂ ਦੇ ਦੇਖਭਾਲ ਦੇ ਲਈ ਦੱਸਦੀ ਹਾਂ ਵਾਲਾਂ ਨੂੰ ਸਭ ਤੋਂ ਪਹਿਲਾਂ ਸਰੋਂ ਦਾ ਤੇਲ ਲਗਵਾਇਆ ਜਾਂਦਾ ਹੈ ਸਰੋਂ ਦੇ ਤੇਲ ਵਿੱਚ ਮੇਥੇ ਗਰਮ ਕਰਕੇ ਭੁੰਨ ਕੇ ਜਦੋਂ ਤੱਕ ਤੇਲ ਗਰਮ ਨਹੀਂ ਹੋ ਜਾਂਦਾ ਗਰਮ ਕਰਕੇ ਫਿਰ ਠੰਡਾ ਕਰਕੇ ਉਸਨੂੰ ਅਸੀਂ ਵਾਲਾਂ ਦੇ ਵਿੱਚ ਲਗਵਾਉਂਦੇ ਹਾਂ ਤਾਂ ਵਾਲਾਂ ਦੀ ਸਿਕਰੀ ਵੀ ਮਰਦੀ ਹੈ ਅਤੇ ਵਾਲਾਂ ਦਾ ਝੜਨਾ ਵੀ ਬੰਦ ਹੁੰਦਾ ਹੈ ਇਹ ਅਸੀਂ ਜਦੋਂ ਵਾਲਾਂ ਨੂੰ ਤੇਲ ਲਗਾ ਕੇ ਤੁਰੰਤ ਹੀ ਸਾਨੂੰ ਕੰਘੀ ਨਹੀਂ ਕਰਨੇ ਚਾਹੀਦੇ ਕਿਉਂਕਿ ਜੇਕਰ ਅਸੀਂ ਤੁਰੰਤ ਹੀ ਕੰਘੀ ਕਰਦੇ ਹਾਂ ਤਾਂ ਤੇਲ ਲਗਵਾਉਣ ਦੇ ਨਾਲ ਸਾਡੇ ਵਾਲ ਨਾਲ ਨਰ ਨਰਮ ਹੋ ਜਾਂਦੇ ਹਨ ਅਤੇ ਇਸ ਦੇ ਨਾਲ ਜਦੋਂ ਤੁਰੰਤ ਕੰਘੀ ਕਰਦੇ ਹਾਂ ਤਾਂ ਉਹ ਫਿਰ ਝੜਦੇ ਹਨ ਕੰਘੀ ਦੇ ਨਾਲ ਸਾਡੇ ਬਹੁਤ ਜ਼ਿਆਦਾ ਵਾਲ ਸਿਰ ਤੋਂ ਨਿਕਲਦੇ ਹਨ ਅਤੇ ਇਸ ਦੇ ਨਾਲ ਹੀ ਸਾਡੇ ਵਾਲ ਦੁੱਖਦੇ ਵੀ ਹਨ ਅਤੇ ਹੁਣ ਮੈਂ ਤੁਹਾਨੂੰ ਚਮੜੀ ਦੀ ਦੇਖਭਾਲ ਲਈ ਕੁਛ ਨੁਸਖੇ ਦੱਸਦੀ ਹਾਂ ਅਤੇ ਚਮੜੀ ਦੀ ਦੇਖ ਭਾਲ ਲਈ ਅਸੀਂ ਸ ਪਾਣੀ ਦੇ ਵਿੱਚ ਨਿੰਮ ਦੇ ਪੱਤਿਆਂ ਨੂੰ ਪੱਤਿਆਂ ਨੂੰ ਉਬਾਲ ਕੇ ਅਤੇ ਅਸੀਂ ਫਿਰ ਉਸ ਪਾਣੀ ਨੂੰ ਠੰਡਾ ਕਰਕੇ ਨਹਾਉਂਦੇ ਹਾਂ ਤਾਂ ਸਾਡੀ ਚਮੜੀ ਦੇ ਕਈ ਰੋਗਾਂ ਕਈ ਚਮੜੀ ਦੇ ਕਈ ਰੋਗ ਰੋਗਾਂ ਤੋਂ ਅਸੀਂ ਛੁਟਕਾਰਾ ਪਾਉਂਦੇ ਹਾਂ ਫਿੰਨਸੀਆਂ ਦਾਨੇ ਕਈ ਤਰ੍ਹਾਂ ਦੇ ਰੋਗ ਦੂਰ ਹੋ ਜਾਂਦੇ ਹਨ ਤੇ ਇਸ